ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸੰਗੀਤ ਮੰਡਲੀਆਂ ਹਨ ਭਜਨ ਮੰਡਲੀਆਂ ਹਨ ਉਹ ਅਲੱਗ ਅਲੱਗ ਤਰ੍ਹਾਂ ਦੇ ਪ੍ਰਦਰਸ਼ਨ ਕਰਦੇ ਹਨ ਔਰ ਘਰ ਘਰ ਜਾ ਕੇ ਆਪਣੇ ਗੁਰੂਆਂ ਦੇ ਪ੍ਰਵਚਨ ਸੁਣਾਉਂਦੇ ਹਨ ਮੈਂ ਇੱਕ ਜਗਰਾਤੇ ਵਿੱਚ ਗਿਆ ਉੱਥੇ ਮੈਨੂੰ ਬਹੁਤ ਜ਼ਿਆਦਾ ਆਨੰਦ ਆਇਆ ਉਹਨਾਂ ਨੇ ਮਾਤਾ ਤਾਰਾ ਰਾਣੀ ਦੀ ਕਥਾ ਸੁਣਾਈ ਉਹਦੇ ਵਿੱਚ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਇਹਦੀ ਔਰ ਇੱਕ ਦਿਨ ਮੈਂ ਉਹਦੇ ਉਹ ਝਾਕੀਆਂ ਵੀ ਬਹੁਤ ਕੱਢਦੇ ਹਨ ਅਲੱਗ ਅਲੱਗ ਤਰ੍ਹਾਂ ਦੀਆਂ ਆਪਣੇ ਜੈਸੇ ਕਿ ਹਰਮੋਨੀਅਮ ਤਬਲਾ ਗਿਟਾਰ ਇਹੋ ਜਿਹੇ ਇੰਸਟੂਮੈਂਟ ਯੂਜ਼ ਕਰਦੇ ਹਨ ਮੈਨੂੰ ਉਹਨਾਂ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹੁੰਦਾ ਹਾਂ ਉਹਨਾਂ ਵੱਲ ਦੇਖ ਕੇ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਭਜਨ ਮੰਡਲੀ ਦੇ ਵਿੱਚ ਸ਼ਾਮਿਲ ਹੋਵਾਂ ਮੈਂ ਇੱਕ ਦੋ ਭਜਨ ਮੰਡਲੀਆਂ ਦੇ ਨਾਲ ਗਿਆ ਵੀ ਹਾਂ ਜਗਰਾਤੇ ਵੀ ਜਗਰਾਤੇ 'ਤੇ ਗਿਆ ਉੱਥੇ ਜਾ ਕੇ ਮੈਨੂੰ ਕੁਛ ਗਿਆਨ ਦੀਆਂ ਗੱਲਾਂ ਕਾਫੀ ਸੁਣਨ ਨੂੰ ਮਿਲੀਆਂ ਔਰ ਕਾਫੀ ਅੱਛਾ ਲੱਗਦਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਕਿ ਭਜਨ ਪਰਮਾਤਮਾ ਦਾ ਕਾਫੀ ਨਾਮ ਲਿੱਤਾ ਜਾਂਦਾ ਹੈ ਕਈ ਭਜਨ ਮੰਡਲੀਆਂ ਤਾਂ ਬਹੁਤ ਹੀ ਜ਼ਿਆਦਾ ਘਰ ਘਰ ਜਾ ਕੇ ਪਿੰਡਾਂ ਵਿੱਚ ਜਾ ਕੇ ਕਈਆਂ ਨੂੰ ਗਿਆਨ ਦਿੰਦੀਆਂ ਹਨ ਕਿ ਆਪਣੇ ਗੁਰੂਆਂ ਬਾਰੇ ਆਪਣੇ ਆਪਣੇ ਗੁਰੂਆਂ ਬਾਰੇ ਬਹੁਤ ਕੁਛ ਦੱਸਦੇ ਹਨ ਕਿ ਇਹ ਮਾਤਾ ਰਾਣੀ ਇੱਦਾਂ ਵਾ ਮਾਤਾ ਰਾਣੀ ਨੂੰ ਜ਼ਿਆਦਾ ਸ਼੍ਰੀ ਕ੍ਰਿਸ਼ਨ ਜੀ ਦੇ ਬਾਰੇ ਬਹੁਤ ਜ਼ਿਆਦਾ ਦੱਸਿਆ ਜਾਂਦਾ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਜਨਮ ਸਥਾ ਜਨਮ ਸਥਾਨ 'ਤੇ ਉਹਨਾਂ ਨੂੰ ਜਿੱਦਾਂ ਹੁਣ ਜਿੱਦਾਂ ਜਨਮ ਅਸ਼ਟਮੀ ਆਉਂਦੀ ਹੈ ਉੱਥੇ ਬਹੁਤ ਜ਼ਿਆਦਾ ਝਾਕੀਆਂ ਉਹਨਾਂ ਦੇ ਬਚਪਨ ਤੋਂ ਲੈ ਕੇ ਮਲਕਿ ਵਿਆਹ ਤੱਕ ਸਾਰਾ ਕੁਛ ਦੱਸਿਆ ਜਾਂਦਾ ਹੈ ਝਾਕੀਆਂ ਥਰੁ ਕਿ ਲੋਕ ਦੇਖ ਕੇ ਉਹਨਾਂ ਨੂੰ ਇੱਦਾਂ ਲੱਗਦਾ ਕਿ ਅਸੀਂ ਉਸ ਮਾਹੌਲ ਦੇ ਵਿੱਚ ਹੀ ਪੈਦਾ ਹੋਏ ਹਾਂ ਇੰਨੀਆਂ ਝਾਕੀਆਂ ਦਰਸਾਈਆਂ ਜਾਂਦੀਆਂ ਹਨ ਮੰਦਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਔਰ ਇਹ ਰੌਣਕ ਦੇਖਣ ਨੂੰ ਮਿਲਦੀ ਹੈ ਕਿ ਲੋਕ ਕਿੰਨਾ ਧਾਰਮਿਕ ਨੂੰ ਸਥਾਨਾਂ 'ਤੇ ਜਾ ਕੇ ਖੁਸ਼ ਹਨ ਔਰ ਆਪਣੇ ਗੁਰੂਆਂ ਨੂੰ ਯਾਦ ਕਰਕੇ ਕਿੰਨਾ ਖੁਸ਼ ਹਨ ਮੈਂ ਤਾਂ ਕਈ ਵਾਰੀ ਦੰਗ ਰਹਿ ਜਾਂਦਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਇੰਨੀ ਪਰਾ ਪਰਭਾ ਪਰਮਾਤਮਾ ਦੀ ਮੰਨਿਆ ਜਾਂਦਾ ਹੈ ਕਈ ਵਾਰ ਤਾਂ ਮੈਨੂੰ ਯਕੀਨ ਹੀ ਨਹੀਂ ਹੁੰਦਾ ਕਿ ਮੈਂ ਆਪਣੇ ਸ਼ਹਿਰ ਦਾ ਵਾਸੀ ਹਾਂ ਸਾਡੇ ਸ਼ਹਿਰ ਦੇ ਵਿੱਚ ਤਾਂ ਗੁਣ ਗਿਆਨ ਔਰ ਪਰਮਾਤਮਾ ਦੇ ਨਾਮ ਤੇ ਤਾਂ ਲਏ ਜਾਂਦੇ ਹਨ ਸੋਚ ਹੀ ਨਹੀਂ ਸਕਦੇ ਚਾਰੇ ਕਰ ਜਾ ਕੇ ਆਪਣੇ ਗਿਆਨ ਜਿੱਦਾਂ ਵੰਡਦੇ ਹਨ ਮੈਂ ਵੀ ਇੱਕ ਦੋ ਵਾਰੀ ਕਈਆਂ ਦੇ ਨਾਲ ਘਰ ਗਿਆ ਹਾਂ ਉੱਥੇ ਜਾ ਕੇ ਮੈਂ ਵੀ ਸੁਣਿਆ ਔਰ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਗਿਆਨ ਵੰਡਾਂ ਅਤੇ ਲੋਕਾਂ ਨੂੰ ਗੁਰੂਆਂ ਬਾਰੇ ਗਿਆਨ ਦੇਵਾਂ ਅਤੇ ਉਹ ਹੋਰ ਜ਼ਿਆਦਾ ਆਪਣਾ ਮੈਂ ਵੀ ਗਿਆਨ ਲੈ ਸਕਾਂ